ਅਸੀਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾ ਰਹੇ ਹਾਂ ਜਿੱਥੇ ਕਿ ਫੀਸਾਂ ਬਹੁਤ ਹੀ ਜ਼ਿਆਦਾ ਹਨ ਪਰ ਮੈਂ ਹੁਣ ਸਾਰਿਆਂ ਨੂੰ ਇਹ ਪ੍ਰੈਫਰ ਕਰਦਾ ਹਾਂ ਕਿ ਸਾਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣਾ ਚਾਹੀਦਾ ਹੈ ਕਿਉਂਕਿ ਭਗਵੰਤ ਮਾਨ ਦੀ ਸਰਕਾਰ ਦੇ ਆਉਣ ਤੋਂ ਬਾਅਦ ਸਰਕਾਰੀ ਸਕੂਲ ਬਹੁਤ ਹੀ ਬਦਲ ਗਏ ਹਨ ਅਤੇ ਉਹਨਾਂ ਦੀ ਪੜ੍ਹਾਈ ਬਹੁਤ ਹੀ ਉੱਚ ਪੱਧਰ 'ਤੇ ਚਲੀ ਗਈ ਹੈ ਅਤੇ ਬਹੁਤ ਟੀਚਰ ਵੀ ਬਹੁਤ ਵਧੀਆ ਰੱਖੇ ਗਏ ਹਨ ਅਤੇ ਪੜ੍ਹਾਈ ਪ੍ਰਾਈਵੇਟ ਸਕੂਲਾਂ ਤੋਂ ਵੀ ਵਧੀਆ ਹੋ ਰਹੀ ਹੈ ਅਤੇ ਫੀਸਾਂ ਵੀ ਬਹੁਤ ਘੱਟ ਹਨ ਕਈਆਂ ਸਕੂਲਾਂ 'ਚ ਤਾਂ ਫੀਸਾਂ ਬਿਲਕੁਲ ਹੀ ਮਾਫ ਹਨ ਅਤੇ ਇੱਥੇ ਸਾਰਾ ਕੁਝ ਹੀ ਫਰੀ ਹੈ ਪ੍ਰਾਈਵੇਟ ਸਕੂਲਾਂ ਵਾਲੇ ਤਾਂ ਫੀਸਾਂ ਦੇ ਬਦਲੇ ਬੱਚਿਆਂ ਨੂੰ ਪੜ੍ਹਾ ਰਹੇ ਹਨ ਅਤੇ ਇੱਥੇ ਫੀਸਾਂ ਵੀ ਬਹੁਤ ਜ਼ਿਆਦਾ ਹਨ ਫੈਸਿਲਿਟੀ ਵੀ ਕੋਈ ਨਹੀਂ ਹੈ ਨਾ ਹੀ ਅੱਜ ਕੱਲ੍ਹ ਬੱਚੇ ਇੱਥੇ ਪੜ੍ਹ ਰਹੇ ਹਨ ਸਗੋਂ ਸਰਕਾਰੀ ਸਕੂਲਾਂ ਦੇ ਬੱਚੇ ਪ੍ਰਾਈਵੇਟ ਨਾਲੋਂ ਜ਼ਿਆਦਾ ਪੜ੍ਹ ਰਹੇ ਹਨ ਅਤੇ ਇੱਥੇ ਟੀਚਰ ਵੀ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਹਨ ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਸਰਕਾਰ ਦਾ ਸਾਥ ਦੇ ਸਕੀਏ ਅਤੇ ਸਰਕਾਰੀ ਪੜ੍ਹਾਈ ਨੂੰ ਹੋਰ ਉੱਚ ਪੱਧਰ ਤੱਕ ਖਟ ਸਕੀਏ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਚੱਲ ਰਹੇ ਲੁੱਟ ਨੂੰ ਰੋਕ ਸਕੀਏ